ਨਮਸਕਾਰ ਜੀ ਨਰੇਸ਼ ਬੋਲ ਰਿਹਾ ਮੈਂ ਮਕੇ ਸਵੇਰੇ ਚਾਰ ਵਜੇ ਪੰਜ ਵਜੇ ਉੱਠ ਜਾਂਦਾ ਹਾਂ ਸੈਰ ਨੂੰ ਨਿਕਲ ਜਾਈਦਾ ਸਵੇਰੇ ਇੱਥੋਂ ਦੀ ਪਾਰਕ 'ਚ ਜਾਈਦਾ ਆ ਉੱਥੇ ਐਕਸਿਸ ਵਗੈਰਾ ਲਗਾਈ ਦੀ ਹੈ ਯੋਗਾ ਕਰੀਦਾ ਸੈਰ ਕਰੀਦੀ ਆ ਉਹਦੇ ਨਾਲ ਮਤਲਬ ਮੱਕੀ ਸਰੀਰ ਦੀ ਫੀਲਿੰਗ ਬਹੁਤ ਵਧੀਆ ਆਉਂਦੀ ਹੈ ਇੱਕ ਤਾਂ ਗੁੱਸਾ ਨਹੀਂ ਆਉਂਦਾ ਘਰ ਆ ਕੇ ਕੋਈ ਗੁੱਸਾ ਨਹੀਂ ਹੈ ਸਟੈਮੀਨਾ ਵੱਧਦਾ ਆ ਟੈਨਸ਼ਨਾਂ ਦੂਰ ਹੋ ਜਾਂਦੀਆਂ ਆ ਸਰੀਰ 'ਚ ਤੰਦਰੁਸਤੀ ਆਉਂਦੀ ਹੈ ਮਕ ਪੂਰਾ ਸਰੀਰ ਪੂਰਾ ਫਿੱਟ ਲੱਗਦਾ ਸਰੀਰ ਕੰਮ ਜਦੋਂ ਕੰਮ 'ਤੇ ਜਾਓ ਕੰਮ 'ਤੇ ਵੀ ਮਤਕੀ ਬਿਲਕੁਲ ਸਰੀਰ ਫਿੱਟ ਰਹਿੰਦਾ ਆ ਕੋਈ ਉਹ ਜਿਹੀ ਬੰਦੇ ਨੂੰ ਬਿਮਾਰੀਆਂ ਛੱਤੀ ਬਿਮਾਰੀਆਂ ਦੂਰ ਹੁੰਦੀਆਂ ਇਹਦੇ ਨਾਲ ਯੋਗਾ ਕਰਨ ਨਾਲ ਐਕਸਰਸਾਈਜ਼ ਕਰੇ ਬੰਦਾ ਸਰੀਰ ਦੇ ਪੇਟ ਦੀਆਂ ਸਾਰੀਆਂ ਐਕਸਰਸਾਈਜ਼ਾਂ ਵਗੈਰਾ ਲਗਾਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵਧੀਆ ਦਿਨ ਨਿਕਲਦਾ ਆ ਬਹੁਤ ਵਧੀਆ ਦਿਨ ਨਿਕਲਦਾ ਆ ਅਤੇ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹ ਵੀ ਮੇਰੇ ਨਾਲ ਰਲਣ ਅਜੇ ਮਤਲਬ ਕਿ ਚਾਰ ਪੰਜ ਮੁੰਡੇ ਮੇਰੇ ਨਾਲ ਰਲੇ ਦੇ ਹੈ ਜਿਹੜੇ ਮੇਰੇ ਨਾਲ ਸੈਰ ਕਰਨ ਜਾਂਦੇ ਆ ਅਤੇ ਉਹਨਾਂ ਨੂੰ ਬਹੁਤਾ ਅੱਛਾ ਫੀਲ ਹੋ ਰਿਹਾ ਬਹੁਤ ਵਧੀਆ ਮੈਂ ਕਹਿੰਦਾ ਕਿ ਮੇਰੇ ਨਾਲ ਵੱਧ ਤੋਂ ਵੱਧ ਮੁੰਡੇ ਜੁੜਨ ਜੋ ਸੈਰ ਕਰਨ ਯੋਗਾ ਕਰਨ ਜਿੰਮ ਵਗੈਰਾ ਲਗਾਉਣ ਅੱਜ ਕੱਲ੍ਹ ਤਾਂ ਪਾਰਕਾਂ ਦੇ ਵਿੱਚ ਜਿੰਮ ਵੀ ਲੱਗ ਗਈ ਹੋਈ ਹੈ ਜਿਹਨੇ ਐਕਸਰਸਾਈਜ਼ ਲਗਾਉਣੀ ਐਕਸਰਸਾਈਜ਼ ਲਗਾਏ ਜਿੰਮ ਵਗੈਰਾ ਸਭ ਕੁਛ ਲਗਾ ਸਕਦਾ ਆ ਬਹੁਤ ਵਧੀਆ ਅੱਜ ਕੱਲ੍ਹ ਫੇਲ ਹੋ ਰਿਹਾ ਬੰਦਾ ਬਾਹਰ ਜਾਂਦਾ ਨਹਿਰਾਂ 'ਤੇ ਪਾਣੀ ਛੱਡਿਆ ਹੋਇਆ ਇਸ ਲਈ ਬਾਹਰ ਦੀ ਹਵਾ ਠੰਢੀ ਠੰਢੀ ਹਵਾ ਮਜ਼ਾ ਆਉਂਦਾ ਹੈ ਰਹਿਣ ਦਾ ਬੜਾ ਵਧੀਆ ਦਿਨ ਨਿਕਲਦਾ ਜੀ